ਲਚਕਤਾ ਵਧਾਉਣ ਵਾਲੀਆਂ ਕਸਰਤਾਂ ਬਹੁਤ ਹੀ ਮਹੱਤਵਪੂਰਨ ਹਨ ਕਿਉਂਕਿ ਸਾਡੇ ਸਰੀਰ ਨੂੰ ਸਰਲ ਬਣਾ ਦਿੰਦੀਆਂ ਹਨ ਮਾਸਪੇਸ਼ੀਆਂ ਦੀ ਜਕੜ ਨੂੰ ਘਟਾਉਂਦੀਆਂ ਹਨ ਦਿਨਚਰਿਆ ਵਿੱਚ ਆਸਾਨੀ ਪੈਦਾ ਕਰਦੀਆਂ ਹਨ ਜਦੋਂ ਅਸੀਂ ਨਿਯਮਤ ਤੌਰ 'ਤੇ ਲਚਕਤਾ ਵਾਲੀਆਂ ਕਸਰਤਾਂ ਕਰਦੇ ਹਾਂ ਤਾਂ ਇਹ ਨਾ ਸਿਰਫ ਸਾਡੇ ਸਰੀਰ ਦੀਆਂ ਹੱਡੀਆਂ ਅਤੇ ਜੋੜਾਂ ਦੀ ਤੰਦਰੁਸਤੀ ਲਈ ਲਾਭਦਾਇਕ ਹੁੰਦੀਆਂ ਹਨ ਸਗੋਂ ਸਾਡੀ ਆਮ ਜੀਵਨ ਸ਼ੈਲੀ ਨੂੰ ਵੀ ਸੁਧਾਰਦੀਆਂ ਹਨ ਲਚਕ ਦੀਆਂ ਦੀਆਂ ਕਈ ਤਰੀਕਿਆਂ ਦੀਆਂ ਕਸਰਤਾਂ ਹੁੰਦੀਆਂ ਹਨ ਜੋ ਸਾਡੇ ਸਰੀਰ ਦੇ ਵੱਖ ਵੱਖ ਹਿੱਸਿਆਂ 'ਤੇ ਪ੍ਰਭਾਵ ਪਾਉਂਦੀਆਂ ਹਨ ਕੁਝ ਪ੍ਰਮੁੱਖ ਪ੍ਰਭਾਵਸ਼ਾਲੀ ਅਤੇ ਲਚਕਤਾ ਵਧਾਉਣ ਵਾਲੀਆਂ ਕਸਰਤਾਂ ਦਿੱਤੀਆਂ ਗਈਆਂ ਹਨ ਜੋ ਉਮਰ ਦੇ ਵਿਅਕਤੀ ਲਈ ਲਾਭਕਾਰੀ ਹੋ ਸਕਦੀਆਂ ਹਨ ਜਿਵੇਂ ਹਮਸਟਰਿੰਗ ਸਟਰੈਚ ਇਹ ਕਸਰਤ ਪਿੱਠ ਦੇ ਪੈਰ ਦੀ ਮਾਸਪੇਸ਼ੀ ਦੀ ਲਚਕਤਾ ਵਧਾਉਣ ਲਈ ਸਭ ਤੋਂ ਵਧੀਆ ਹਨ ਕਿਵੇਂ ਕਰਨੀ ਹੈ ਇਸ ਤਰ੍ਹਾਂ ਇਹ ਕਸਰਤ ਕੀਤੀ ਜਾ ਸਕਦੀ ਹੈ ਸਿੱਧੇ ਖੜ੍ਹੇ ਹੋ ਜਾਓ ਅਤੇ ਹੌਲੀ ਹੌਲੀ ਆਪਣੀ ਕਮਰ ਨੂੰ ਝੁਕਾਓ ਆਪਣੇ ਪੈਰ ਦੇ ਅੰਗੂਠੇ ਛੋਹਣ ਦੀ ਕੋਸ਼ਿਸ਼ ਕਰੋ ਜਦਕਿ ਤੁਹਾਡੀਆਂ ਗੋਡੇ ਬਿਲਕੁਲ ਸਿੱਧੇ ਰਹਿਣੇ ਚਾਹੀਦੇ ਹਨ ਵੀਹ ਜਾਂ ਤੀਹ ਸਕਿੰਟ ਤੱਕ ਇਸ ਸਥਿਤੀ ਵਿੱਚ ਰਹੋ ਹੌਲੀ ਹੌਲੀ ਵਾਪਸ ਖੜ੍ਹੇ ਹੋਵੋ ਝਟਕਾ ਬਿਲਕੁਲ ਵੀ ਨਹੀਂ ਲੈਣਾ ਹੈ ਲਾਭ ਇਸਦੇ ਕੀ ਹੋਣਗੇ ਪਿਛਲੇ ਪੈਰ ਦੀ ਮਾਸਪੇਸ਼ੀ ਨੂੰ ਲਚਕਦਾਰ ਬਣਾਉਂਦੀ ਹੈ ਪੈਰਾਂ ਵਿੱਚ ਖਿੱਚ ਨੂੰ ਘਟਾਉਂਦੀ ਹੈ ਬੈਠਣ ਉੱਠਣ ਦੇ ਪੋਸਚਰ ਨੂੰ ਸੁਧਾਰਦੀ ਹੈ ਨੰਬਰ ਦੋ 'ਤੇ ਜਿਵੇਂ ਕੂਲ੍ਹਿਆਂ ਦੀ ਲਚਕਤਾ ਵਧਾਉਣ ਵਾਲੀ ਕਸਰਤ ਕੂਲ੍ਹੇ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਜੋ ਚੱਲਣ ਦੌੜਨ ਅਤੇ ਬੈਠਣ ਵਿੱਚ ਕਾਫੀ ਭੂਮਿਕਾ ਨਿਭਾਉਂਦੇ ਹਨ ਇਹ ਕਸਰਤ ਤੁਸੀਂ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਜ਼ਮੀਨ 'ਤੇ ਬੈਠੋ ਆਪਣਾ ਇੱਕ ਪੈਰ ਅੱਗੇ ਲਿਆਓ ਦੂਜੇ ਪੈਰ ਨੂੰ ਆਪਣੇ ਪਿੱਠ ਦੇ ਪਾਸੇ ਮੋੜੋ ਆਪਣੇ ਅੱਗੇ ਵਾਲੇ ਪੈਰ ਨੂੰ ਹੌਲੀ ਹੌਲੀ ਧੱਕੋ ਤੀਹ ਸਕਿੰਟ ਤੱਕ ਰੁਕੋ ਫਿਰ ਪੈਰ ਬਦਲੋ ਇਸ ਦੇ ਨਾਲ ਕੀ ਲਾਭ ਮਿਲੇਗਾ ਕੂਲ੍ਹਿਆਂ ਦੀ ਲਚਕਤਾ ਨੂੰ ਵਧਾਊਗਾ ਲੰਬੇ ਸਮੇਂ ਬੈਠਣ ਕਰਕੇ ਹੋਣ ਵਾਲੀ ਜਕੜ ਨੂੰ ਘਟਾਉਂਦਾ ਹੈ ਪੈਰਾਂ ਵਿੱਚ ਖਿੱਚ ਨੂੰ ਘਟਾਉਂਦਾ ਹੈ ਕੰਧੇ ਨੂੰ ਸਟਰੈਚ ਕਰਨ ਲਈ ਕੰਧੇ ਦੀ ਲਚਕਤਾ ਵਧਾਉਣ ਲਈ ਇਹ ਬਹੁਤ ਹੀ ਆਸਾਨ ਅਤੇ ਪ੍ਰਭਾਵਸ਼ਾਲੀ ਕਸਰਤ ਹੈ ਇਹ ਕਿਵੇਂ ਕਰਨੀ ਚਾਹੀਦੀ ਹੈ ਖੜ੍ਹੇ ਹੋ ਕੇ ਇੱਕ ਬਾਂਹ ਨੂੰ ਥਰੜੇ ਪਾਸੇ ਲਿਜਾਓ ਥੱਲੜੇ ਦੂਜੇ ਹੱਥ ਦੀ ਮਦਦ ਨਾਲ ਇਸ ਨੂੰ ਹੌਲੀ ਹੌਲੀ ਤਣਾਅ ਦਿਓ ਵੀਹ ਜਾਂ ਤੀਹ ਸਕਿੰਟ ਤੱਕ ਰੱਖੋ ਫਿਰ ਬਾਂਹ ਬਦਲੋ ਇਸ ਦਾ ਕੀ ਲਾਭ ਹੋਵੇਗਾ ਮੋਢਿਆਂ ਵਿੱਚ ਆਉਣ ਵਾਲੀ ਜਕੜਨ ਨੂੰ ਘਟਾਉਂਦਾ ਹੈ ਮੋਢਿਆਂ ਦੀ ਗਤੀਸ਼ੀਲਤਾ ਵਧਾਉਂਦਾ ਹੈ ਲੰਬੇ ਸਮੇਂ ਤੱਕ ਕੰਪਿਊਟਰ ਜਾਂ ਲੈਪਟਾਪ 'ਤੇ ਕੰਮ ਕਰਨ ਵਾਲਿਆਂ ਲਈ ਲਾਭਕਾਰੀ ਹੈ ਨੰਬਰ ਚਾਰ 'ਤੇ ਬੈਕ ਹੈਂਡ ਜਾਂ ਪਿੱਠ ਦੀ ਲਚਕਤਾ ਵਧਾਉਣ ਲਈ ਕਸਰਤ ਇਹ ਕਸਰਤ ਪਿੱਠ ਦੀ ਲਚਕਤਾ ਵਧਾਉਣ ਅਤੇ ਕਮਰ ਦੀ ਦਰਦ ਨੂੰ ਘਟਾਉਣ ਲਈ ਸਭ ਤੋਂ ਵਧੀਆ ਹੈ ਇਹ ਕਿਵੇਂ ਕਰਨੀ ਹੈ ਆਪਣੀ ਪਿੱਠ ਦੇ ਲੰਬੇ ਹੋ ਜਾਓ ਆਪਣੇ ਹੱਥਾਂ ਦੀ ਮਦਦ ਨਾਲ ਪਿੱਠ ਨੂੰ ਹੌਲੀ ਹੌਲੀ ਉੱਤੇ ਉਠਾਓ ਵੀਹ ਜਾਂ ਤੀਹ ਸਕਿੰਟ ਤੱਕ ਕਰਦੇ ਰਹੋ ਹੌਲੀ ਹੌਲੀ ਵਾਪਸ ਆਓ ਲਾਭ ਪਿੱਠ ਦੀ ਤਾਕਤ ਅਤੇ ਲਚਕਤਾ ਵਧਾਉਂਦੀ ਹੈ ਪਿੱਠ ਵਿੱਚ ਹੋਣ ਵਾਲੀ ਖਿੱਚ ਨੂੰ ਘਟਾਉਂਦੀ ਹੈ ਸਰੀਰ ਦੀ ਸਥਿਤੀ ਨੂੰ ਬਿਹਤਰ ਬਣਾਉਂਦੀ ਹੈ